ਸਾਡੇ ਪਿੰਡ ਵਿੱਚ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਕਈ ਸਾਰੇ ਇਤਿਹਾਸਿਕ ਸਥਾਨ ਹਨ ਮੰਦਿਰ ਹਨ ਮ ਗੁਰਦੁਆਰੇ ਮਸਜਿਦ ਕਰ ਕਈ ਤਰ੍ਹਾਂ ਦੇ ਇਤਿਹਾਿਕਸ ਸਥਾਨ ਹਨ ਅਤੇ ਮੈਂ ਇੱਕ ਵਾਰ ਇੱਕ ਗੁਰਦੁਅ ਕਾਫੀ ਵਾਰ ਗੁਰਦੁਆਰੇ ਗਿਆ ਹਾਂ ਸਾਡੇ ਪਿੰਡ ਦੇ ਕੋਲ ਇੱਕ ਗੁਰਦੁਆਰਾ ਹੈ ਗੁਰਦੁਆਰਾ ਟਿੱਬੀ ਸਾਹਿਬ ਜੋ ਕਿ ਸਾਡੇ ਪਿੰਡ ਤੋਂ ਅੱਠ ਕਿਲੋਮੀਟਰ ਦੂਰ ਹੈ ਜੋ ਕਿ ਕਾਫੀ ਪ੍ਰਸਿੱਧ ਗੁਰਦੁਆਰਾ ਹੈ ਇੱਥੇ ਡੇਲੀ ਕਈ ਸੰਗ ਇੱਕ ਵੱਡੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਹਨ ਮੈਂ ਰੀਸੈਂਟਲੀ ਦੋ ਦਿਨ ਪਹਿਲਾਂ ਹੀ ਉੱਥੇ ਗਿਆ ਸੀ ਆਪਣੇ ਦੋਸਤਾਂ ਨਾਲ ਗਿਆ ਸੀ ਉੱਥੇ ਏ ਅਸੀਂ ਜਾਂਦੇ ਜਾਂਦੇ ਸਭ ਤੋਂ ਪਹਿਲਾਂ ਆ ਕੇ ਮੱਥਾ ਟੇਕਿਆ ਅਤੇ ਪੰਦਰ੍ਹਾਂ ਵੀਹ ਮਿੰਟ ਬੈਠੇ ਆ ਅਤੇ ਕੀਰਤਨ ਸੁਣਿਆ ਉਸਤੋਂ ਕੀਰਤਨ ਸੁਣਿਆ ਜਿੱਥੇ ਸਾਨੂੰ ਕਾਫੀ ਪੀਸਫੁਲ ਫੀਲ ਹੋਇਆ ਉਸ ਤੋਂ ਬਾਅਦ ਆਪਾਂ ਇਹ ਕਾਫੀ ਇੰਪੋਟੈਂਟ ਨਿਸ਼ਾਨ ਇਂਪੋ ਗੁਰਦੁਆਰੇ ਦੇ ਇਂਪੋਟੈਂਟ ਥਾਵਾਂ 'ਤੇ ਜਾ ਕੇ ਮੱਥਾ ਟੇਕਿਆ ਅਤੇ ਵਧੀਆ ਫੀਲ ਕੀਤਾ ਉਸ ਤੋਂ ਬਾਅਦ ਆਪਾਂ ਲੰਗਰ ਛਕਣ ਗਏ ਲੰਗਰ ਵਿੱਚ ਆਪਾਂ ਕੜ੍ਹੀ ਖਾਧੀ ਅਤੇ ਲੰਗਰ ਕਾਫੀ ਸਵਾਦ ਸੀ ਲੰਗਰ ਖਾਣ ਤੋਂ ਬਾਅਦ ਆਪਾਂ ਭਾਂਡੇ ਧੋਤੇ ਸੇਵਾ ਕੀਤੀ ਥੋੜ੍ਹੀ ਅਤੇ ਉਸ ਤੋਂ ਬਾਅਦ ਏ ਲੰਗਰ ਖਾ ਕੇ ਆਪਾਂ ਲੰਗਰ ਹਾਲ ਤੋਂ ਬਾਹਰ ਆਏ ਫਿਰ ਆਪਾਂ ਪਾਰਕ ਵਿੱਚ ਦਸ ਪੰਦਰ੍ਹਾਂ ਮਿੰਟ ਬੈਠੇ ਇੱਥੇ ਇੱਕ ਫੋਟੋ ਫੋਟੋਜ਼ ਖਿੱਚੀਆਂ ਇੱਕ ਦੂਜੇ ਦੀਆਂ ਕਾਫੀ ਆਪਾਂ ਮੰਨੋਰੰਜਨ ਕੀਤਾ ਅਤੇ ਫਿਰ ਆਪਾਂ ਕਾਫੀ ਟਾਈਮ ਗੁਰਦੁਆਰੇ ਵਿੱਚ ਜਾ ਕੇ ਵਾਪਸ ਆ ਗਏ ਉਸ ਗੁਰਦੁਆਰੇ ਦਾ ਇਤਿਹਾਸ ਵਿੱਚ ਸਾਡੇ ਬਹੁਤ ਮਹੱਤਵ ਹੈ ਕਿਉਂਕਿ ਉੱਥੇ ਇਤਿਹਾਸ ਵਿੱਚ ਕਿਉਂਕਿ ਉਹਨਾਂ ਦੇ ਕਾਫੀ ਮਹਾਨ ਸ਼ਖਸ਼ੀਅਤ ਸ਼ਖਸ਼ੀਅਤ ਉੱਥੇ ਰਹਿੰਦੇ ਸਨ ਅਤੇ ਉਹਨਾਂ ਦੀ ਇੱਕ ਕਾਫੀ ਪ੍ਰਸਿੱਧ ਗੱਡੀ ਵੀ ਹੈ ਜੋ ਕਿ ਦੂਰੋਂ ਦੂਰੋਂ ਲੋਕੀ ਉੱਥੇ ਦੇਖਣ ਆਉਂਦੇ ਹਨ